ਸਤਿ ਸ਼੍ਰੀ ਅਕਾਲ ਪੰਦਰ੍ਹਾਂ ਦਿਨ ਪਹਿਲਾਂ ਮੈਂ ਔਡਰ ਕੀਤਾ ਸੀ ਫਸਟਲੀ ਉਹਦਾ ਦੋ ਤਿੰਨ ਦਿਨ ਬਾਅਦ ਲੇਟ ਆਏ ਸਨ ਫਿਰ ਉਹਨਾਂ ਨੂੰ ਓਪਨ ਕੀਤਾ ਤਾਂ ਉਹਨਾਂ ਦੀ ਪੈਕਜਿੰਗ ਬਹੁਤ ਜ਼ਿਆਦਾ ਘਟੀਆ ਕੀਤੀ ਹੋਈ ਸੀ ਜੋ ਬੋਟ ਦਿੱਤੇ ਹੋਏ ਸਨ ਉਹ ਬਹੁਤ ਜ਼ਿਆਦਾ ਹੀ ਡਾਰਕਲੀ ਸਨ ਜੋ ਮੈਂ ਔਡਰ ਕੀਤਾ ਸੀ ਉਹ ਤਾਂ ਬਹੁਤ ਲਾਈਟ ਸਨ ਅਤੇ ਉਹਨਾਂ ਦੇ ਫੀਤੇ ਵੀ ਜ਼ਿਆਦਾ ਬਹੁਤ ਜ਼ਿਆਦਾ ਖਰਾਬ ਸਨ ਖਿੱਚਣ 'ਤੇ ਵੀ ਟੁੱਟ ਰਹੇ ਸਨ ਅਤੇ ਉਹਨਾਂ ਦੇ ਪਤਾਮੇ ਵੀ ਬਹੁਤ ਹਾਡ ਸਨ ਜਿਹਨੂੰ ਅਸੀਂ ਪਾ ਨਹੀਂ ਸਕਦੇ ਸੀ ਸੋਊਲ ਵੀ ਬਹੁਤ ਜ਼ਿਆਦਾ ਹੈਵੀ ਸਨ ਅਤੇ ਬੂਟ ਵੀ ਬਹੁਤ ਹੈਵੀ ਸਨ ਜਿਨਾਂ ਨੂੰ ਅਸੀਂ ਪਾ ਕੇ ਤੁਰ ਨਹੀਂ ਸਕਦੇ ਜਿਸ ਨਾਲ ਪੈਰ ਦਰਦ ਹੋਣ ਲੱਗ ਜਾਂਦੇ ਹਨ ਅਤੇ ਉਹ ਬਹੁਤ ਜ਼ਿਆਦਾ ਮਹਿੰਗੇ ਵੀ ਲੱਗ ਰਹੇ ਸਨ ਕਿਉਂਕਿ ਮਾਰਕਿਟ ਵਿੱਚ ਤਾਂ ਇਸ ਤੋਂ ਵਧੀਆ ਵੀ ਮਿਲ ਵਧੀਆ ਮਿਲ ਜਾਂਦੇ ਹਨ ਕੁਆਲਿਟੀ ਵੀ ਕੁਝ ਜ਼ਿਆਦਾ ਘਟੀਆ ਹੀ ਸੀ ਵਧੀਆ ਨਹੀਂ ਸੀ ਅਤੇ ਮੇਰੇ ਦੋਸਤ ਨੇ ਵੀ ਔਡਰ ਕੀਤਾ ਹੋਇਆ ਸੀ ਤਾਂ ਮੈਂ ਉਨ੍ਹਾਂ ਤੋਂ ਔਡਰ ਕੈਂਸਲ ਕਰਵਾ ਦਿੱਤਾ ਕਿਉਂਕਿ ਮੈਨੂੰ ਇਹ ਬੂਟ ਬਹੁਤ ਜ਼ਿਆਦਾ ਹੀ ਘਟੀਆ ਲੱਗੇ ਸਨ ਪਲੀਜ਼ ਤੁਸੀਂ ਮੇਰੇ ਪੈਸੇ ਵਾਪਿਸ ਕਰ ਦਿਓ ਜਾਂ ਮੇਰਾ ਔਡਰ ਓਹੀ ਭੇਜ ਦਿਓ ਧੰਨਵਾਦ